ਜਦੋਂ ਮੈਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀਗਾ ਉਦੋਂ ਮੇਰੀ ਆਪਣੀ ਵਰਕਸ਼ਾਪ ਹੋਣ ਕਰਕੇ ਘਰ ਦੀ ਵਰਕਸ਼ਾਪ ਹੋਣ ਕਰਕੇ ਮੈਨੇ ਜੋ ਸਾਗ ਬਣਦਾ ਸੀਗਾ ਸਾਗ ਚੀਰਨ ਵਾਲੀਆਂ ਮਸ਼ੀਨਾਂ ਪਹਿਲਾਂ ਦਾਤੀ ਨਾਲ ਬੁੜੀਆਂ ਚੀਰਦੀਆਂ ਹੁੰਦੀਆਂ ਤੀਆਂ ਉਹ ਸਾਗ ਚੀਰਨ ਵਾਲ਼ੀ ਮਸ਼ੀਨ ਮੈਂ ਆਪਣੇ ਡੈਡੀ ਨਾਲ ਮਿਲ ਕਰਕੇ ਬਣਾਈ ਉਸਦੀ ਚਾਲ ਆ ਜੋ ਗਰਾਰੀਆਂ ਅਤੇ ਉਹ ਸਭ ਆਪ ਤਿਆਰ ਕੀਤੀ ਆ ਬੈਲਡਿੰਗ ਦੀ ਮਦਦ ਨਾਲ ਉਸ ਨੂੰ ਮੈਂ ਆਪਣੇ ਸਕੂਲ 'ਚ ਪੇਸ਼ ਕੀਤਾ ਸਕੂਲ ਵੱਲੋਂ ਇਹ ਲੁਧਿਆਣੇ ਯੂਨੀਵਰਸਿਟੀ 'ਚ ਗਏ ਸੀਗੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤਾਂ ਉੱਥੇ ਏ ਇਹ ਯੂਨੀਵਰਸਿਟੀ ਜੋ ਐਗਰੀਕਲਚਰ ਸ ਯੂਨੀਵਰਸਿਟੀ ਦਾ ਸੰਬੰਧਿਤ ਡਾਇਰੈਕਟਰ ਸੀਗੇ ਚੰਡੀਗੜ੍ਹ ਬੈਠਦੇ ਸੀਗੇ ਚੌਂਤੀ ਸੈਕਟਰ 'ਚ ਉਹ ਆਏ ਹੋਏ ਸੀਗੇ ਉਹਨਾਂ ਨੇ ਪ੍ਰਦਰਸ਼ਨੀ ਜੋ ਲੱਗੀ ਹੋਈ ਤੀ ਉਹਦਾ ਮੁਆਇਨਾ ਕੀਤਾ ਚੈੱਕ ਕੀਤਾ ਤਾਂ ਉਹਨਾਂ ਨੂੰ ਬੜੀ ਪਸੰਦ ਆਈ ਫਿਰ ਮੈਨੂੰ ਉਹ ਸਪੈਸ਼ਲ ਆਪਣਾ ਕਾਰਡ ਦੇ ਕੇ ਗਏ ਆਪਣਾ ਦਫਤਰ ਦਾ ਵੀ ਜੇ ਕਦੇ ਲੋੜ ਹੋਵੇ ਉਹਨਾਂ ਦੀ ਸਲਾਹ 'ਤੇ ਵੀ ਇਹਨੂੰ ਬੱਚੇ ਨੂੰ ਆਪਾਂ ਸੁਧਾਰ ਕਰੀਏ ਅੱਗੇ ਕੋਈ ਲੋਨ ਵਗੈਰਾ ਦੇਵਾਂਗੇ ਇਸਨੂੰ ਕੋਈ ਲੈਣਾ ਕਰਨਾ ਕੋਈ ਮਦਦ ਦੀ ਲੋੜ ਹੋਊ ਪਰ ਬਈ ਮੈਨੂੰ ਚੰਡੀਗੜ੍ਹ ਮਿਲਿਓ ਆ ਕੇ ਉਹਨਾਂ ਨੇ ਬੜੇ ਪਸੰਦ ਆਏ ਅਤੇ ਮੈਨੂੰ ਉਹਦਾ ਫਿਰ ਗਿਫਟ ਵੀ ਮਿਲਿਆ ਉੱਥੇ ਇਨਾਮ ਮਿਲਿਆ ਸਰਟੀਫਿਕੇਟ ਮੈਨੂੰ ਅਲੱਗ ਤੋਂ ਮਿਲਿਆ ਇੱਕ ਸਾਗ ਬਣਾਉਣ ਵਾਲੀ ਮਸ਼ੀਨ ਮੈਂ ਤਿਆਰ ਕੀਤੀ ਸੀ ਆਪਣੇ ਹੱਥੀਂ ਉਹਦਾ ਬੀਲ ਵੀ ਗੜਾਸੇ ਵੀ ਗਰਾਰੀਆਂ ਵੀ ਚਾਲ ਵੀ ਅਤੇ ਜੋ ਅੰਦਰ ਖਿੱਚ ਕੇ ਲੈ ਜਾਂਦੇ ਸਾਗ ਨੂੰ ਉਹ ਵੀ ਸਾਰਾ ਆਪ ਆਪਣੀ ਵਰਕਸ਼ਾਪ 'ਤੇ ਲੋਹੇ ਅਤੇ ਬੈਲਡਿੰਗ ਦੀ ਮਦਦ ਨਾਲ ਤਿਆਰ ਕੀਤਾ